ਟਕਨੋਲਜੀ ਦੇ ਰਾਹੀਂ ਮਨੋਰੰਜਨ ਦੇ ਸਾਧਨ ਬਹੁਤ ਹੀ ਫਰਕ ਪੈ ਗਿਆ ਹੈ ਪਹਿਲਾਂ ਟਕਨੋਲਜੀ ਜਿਵੇਂ ਇੱਕੋ ਟੈਲੀਵਿਜ਼ਨ ਘਰ 'ਚ ਹੁੰਦਾ ਸੀ ਅਤੇ ਚੈਨਲ ਵੀ ਇੱਕ ਹੀ ਲੱਗਦਾ ਸੀ ਜਿਵੇਂ ਡੀ ਡੀ ਵਨ ਹੋ ਗਿਆ ਅਤੇ ਚਾਰ ਪੰਜ ਪ੍ਰੋਗਰਾਮ ਆਉਂਦੇ ਸੀ ਘਰ 'ਚ ਬਹਿ ਕੇ ਸਾਰੇ ਉਹੀ ਇਕੱਠੇ ਵੇਖ ਸਕਦੇ ਸੀ ਪਰ ਅੱਜ ਕੱਲ੍ਹ ਹਰ ਬੰਦਾ ਆਪਣੇ ਆਪਣੇ ਹਿਸਾਬ ਨਾਲ ਵੇਖ ਸਕਦਾ ਜਿਵੇਂ ਬੱਚੇ ਇੱਥੇ ਕਾਰਟੂਨਾਂ ਦੀ ਨੂੰ ਪਸੰਦ ਕਰਦੇ ਹਨ ਅਤੇ ਉਹਨਾਂ ਦੇ ਚੈਨਲ ਵੱਖਰੇ ਹੁੰਦੇ ਹਨ ਜੇ ਕੋਈ ਵੱਡੇ ਨੇ ਤਾਂ ਉਹ ਜਿਵੇਂ ਖੇਡਾਂ ਵਾਲੀਏ ਵੇਖਣਾ ਚਾਹੁੰਦੇ ਉਹਨਾਂ ਦੇ ਸਪੋਰਟ ਚੈਨਲ ਅਲੱਗ ਹੁੰਦੇ ਹਨ ਬਜ਼ੁਰਗ ਗੁਰਬਾਣੀ ਕੀਰਤਨ ਜਾਂ ਨਿਊਜ਼ ਚੈਨਲ ਪਸੰਦ ਕਰਦੇ ਹਨ ਤਾਂ ਉਹਨਾਂ ਦੇ ਚੈਨਲ ਵੱਖਰੇ ਹਨ ਪਹਿਲਾਂ ਸਿਰਫ ਇਹ ਹੁੰਦਾ ਸੀ ਕਿ ਇੱਕੋ ਹੀ ਚੈਨਲ ਹੁੰਦਾ ਸੀ ਜਿੱਥੇ ਨਿਊਜ਼ ਆਉਣੀ ਹੁੰਦੀ ਸੀ ਅਤੇ ਉਹ ਉੱਥੇ ਹੀ ਖਬਰਾਂ ਆਉਂਦੀਆਂ ਸੀ ਅਤੇ ਉੱਥੇ ਹੀ ਨਾਲ ਦੇ ਨਾਲ ਜਿਹੜੇ ਗਾਣੇ ਸੀ ਹੋਰ ਇੱਕ ਦਿਨ ਹੁੰਦਾ ਸੀ ਮਤਲਬ ਕਿ ਹੁਣ ਜਿਹੜਾ ਵਾ ਮਨੋਰੰਜਨ ਦਾ ਸਾਧਨ ਲੋਕ ਆਪਣੇ ਮੋਬਾਈਲਾਂ 'ਤੇ ਹੀ ਸਭ ਕੁਝ ਵੇਖਣ ਲੱਗ ਪਏ ਹਨ ਸੋਸ਼ਲ ਸਾਈਡ ਬਹੁਤ ਜ਼ਿਆਦਾ ਹੋ ਚੁੱਕੀਆਂ ਹਨ ਜਿੱਥੋਂ ਲੋਕ ਆਪਣੇ ਆਪ ਮਨੋਰੰਜਨ ਵੀਡੀਓ ਵੇਖ ਸਕਦੇ ਹਨ ਆਪਣੀ ਮਨਪਸੰਦ ਦੀਆਂ ਵੀਡੀਓ ਵੇਖ ਸਕਦੇ ਹਨ ਅਤੇ ਇਸ ਤੋਂ ਇਲਾਵਾ ਆਪਣੇ ਆਪ ਨੂੰ ਪੇਸ਼ ਵੀ ਓ ਉਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਅੱਗੇ ਕਰ ਸਕਦੇ ਹਨ ਅਗ ਹਰ ਇੱਕ ਨੂੰ ਇੱਕ ਪਲੇਟਫਾਰਮ ਮਿਲ ਚੁੱਕਿਆ ਹੈ ਕਿ ਜਿੱਥੇ ਉਹ ਆਪਣੇ ਆਪ ਨੂੰ ਪੇਸ਼ਕਾਰੀ ਕਰ ਸਕਣ ਭਾਵੇਂ ਉਹ ਬਜ਼ੁਰਗ ਹੋਣ ਬੱਚੇ ਹੋਣ ਆਪਣੀ ਕਲਾ ਨੂੰ ਲੋਕਾਂ ਅੱਗੇ ਸੰਬੋਧਿਤ ਕਰ ਸਕਦੇ ਸਨ ਪਹਿਲਾਂ ਉਹ ਸਿਰਫ ਇਹੀ ਹੁੰਦਾ ਸੀ ਕਿ ਜੋ ਆਏਗਾ ਨਾਟਸ਼ਾਲਾ ਜਾਵੇਗਾ ਜਾਂ ਆਪਣਾ ਦਿਖਾਵੇਗਾ ਉਹੀ ਅੱਗੇ ਆ ਸਕਦਾ ਸੀ ਹੁਣ ਹਰ ਬੰਦੇ ਨੂੰ ਅੱਗੇ ਆਉਣ ਲਈ ਮੋਬਾਈਲ ਨੇ ਅਤੇ ਟੈਕਨੋਲੋਜੀ ਨੇ ਬਹੁਤ ਸਹਾਰਾ ਦਿੱਤਾ ਹੈ ਬੱਚੇ ਆਪਣੀਆਂ ਕਲਾ ਦਿਖਾਉਂਦੇ ਹਨ ਬਜ਼ੁਰਗ ਵੀ ਆਪਣੀਆਂ ਕਲ ਹੁਣ ਕਲਾਕਾਰੀਆਂ ਦਿਖਾਉਂਦੇ ਹਨ ਹਰ ਤਰ੍ਹਾਂ ਦੀ ਟੈਕਨੋਲੋਜੀ ਨੇ ਲੋਕਾਂ ਨੂੰ ਵਿਕਸਿਤ ਹੀ ਕੀਤਾ ਹੈ